ਮੈਂ ਆਪਣੇ ਫਾਰਮ ਨੂੰ ਵੱਡੇ ਪੱਧਰ 'ਤੇ ਵਿਕਸਿਤ ਕਰਨਾ ਚਾਹੁੰਦੀ ਹਾਂ ਮੈਂ ਵੱਧ ਤੋਂ ਵੱਧ ਤਕਨੀਕਾਂ ਦੀ ਵਰਤੋਂ ਕਰਕੇ ਇਸ ਪੋਲਟੀ ਫਾਰਮ ਨੂੰ ਵਿਕਸਿਤ ਕਰਨਾ ਚਾਹੁੰਦੀ ਹਾਂ ਤਾਂ ਕਿ ਇਸਦਾ ਜਿਹੜਾ ਕੰਮ ਹੈ ਉਹ ਵੱਡੇ ਪੱਧਰ ਦਾ ਹੋਵੇ ਅਤੇ ਵੱਧ ਤੋਂ ਵੱਧ ਇਹਦਾ ਜਿਹੜਾ ਲਾਭ ਪ੍ਰਾਪਤ ਹੋਵੇ